ਜੇਕਰ ਅਸੀਂ ਪੰਜਾਬ ਵਿੱਚ ਪ੍ਰਮੁੱਖ ਵਪਾਰਕ ਪਹਿਲ ਕਦਮੀਆਂ ਦੀ ਗੱਲ ਕਰੀਏ ਤਾਂ ਇਸ ਵਿੱਚ ਅਸੀਂ ਸਰਕਾਰ ਵੱਲੋਂ ਪ੍ਰੋਵਾਈਡ ਕੀਤੀਆਂ ਗਈਆਂ ਸਬਸਿਡੀਜ਼ ਦੀ ਗੱਲ ਕਰ ਸਕਦੇ ਹਾਂ ਜਿਵੇਂ ਕਿ ਜੇਕਰ ਕੋਈ ਆਪਣਾ ਨਵਾਂ ਬਿਜ਼ਨਸ ਜਾਂ ਕੋਈ ਇੰਡਸਟਰੀ ਸਥਾਪਿਤ ਕਰਦਾ ਹੈ ਤਾਂ ਸਰਕਾਰ ਵੱਲੋਂ ਉਹਨਾਂ ਨੂੰ ਸਬਸਿਡੀਜ਼ ਦੇ ਰੂਪ ਵਿੱਚ ਕੁਝ ਪੈਸਾ ਪ੍ਰੋਵਾਈਡ ਕਰਵਾਇਆ ਜਾਂਦਾ ਹੈ ਤਾਂ ਜੋ ਅਜਿਹੇ ਤਰ੍ਹਾਂ ਦੀਆਂ ਛੋਟੇ ਕਾਰੋਬਾਰਾਂ ਨੂੰ ਉਤਸ਼ਾਹ ਦਿੱਤਾ ਜਾਵੇ ਸਰਕਾਰੀ ਪੱਧਰ 'ਤੇ ਅੱਜ ਕੱਲ੍ਹ ਤਾਂ ਪ੍ਰਾਈਵੇਟ ਬੈਂਕਸ ਦੇ ਵਿੱਚ ਵੀ ਲੋਨ ਦੀ ਵਿਵਸਥਾ ਪ੍ਰਦਾਨ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਉਹ ਕਾਫੀ ਘੱਟ ਵਿਆਜ਼ 'ਤੇ ਬੈਂਕਾਂ ਤੋਂ ਲੋਨ ਲੈ ਕੇ ਆਪਣਾ ਬਿਜ਼ਨਸ ਸਥਾਪਿਤ ਕਰ ਸਕਣ ਅਤੇ ਜਦੋਂ ਬਾਅਦ ਵਿੱਚ ਉਹਨਾਂ ਨੂੰ ਮੁਨਾਫਾ ਹੋਣਾ ਸ਼ੁਰੂ ਹੋ ਜਾਵੇ ਤਾਂ ਉਹ ਬੈਂਕ ਦਾ ਪੈਸਾ ਵਿਆਜ਼ ਸਾਹਿਤ ਵਾਪਸ ਕਰ ਸਕਣ ਸਰਕਾਰ ਵੱਲੋਂ ਵੀ ਇਹਨਾਂ ਸਟਾਰਟਅਪ ਬਿਜ਼ਨਸ ਲਈ ਬਹੁਤ ਸਾਰੀਆਂ ਸਹੂਲਤਾਂ ਬਿਜਲੀ ਵਿੱਚ ਘੱਟ ਪੈਸੇ ਲੈਣਾ ਇਸ ਤਰ੍ਹਾਂ ਦੀਆਂ ਕਾਫੀ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ